ਹੈਲੋ ਸਰ ਹੈਲੋ ਸਰ ਆਪਾਂ ਟਿਕਟ ਬੁੱਕ ਕਰਾਈ ਸੀ ਪੱਚੀ ਨਵੰਬਰ ਲਈ ਚਾਰ ਟਿਕਟਾਂ ਸੀ

ਹਾਂ ਸਰ ਕੱਲ੍ਹ ਕਰਵਾਈ ਆ ਬੁੱਕ ਅਤੇ ਸਰ ਉਹ ਆਪਾਂ ਟਿਕਟ ਮਤਲਬ ਕੈਂਸਲ ਕਰਵਾਉਣੀ ਹੈ ਕਿਉਂਕਿ ਆਪਾਂ ਹੁਣ ਪੱਚੀ ਤਾਰੀਕ ਨੂੰ ਨਹੀਂ ਜਾ ਸਕਦੇ ਕੁਝ ਫੈਮਿਲੀ ਇਸ਼ੂ ਕਰਕੇ ਹਾਂਜੀ ਹਾਂਜੀ ਸਰ ਫਿਫਟੀ ਪ੍ਰਸੈਂਟ ਡੀਡਕਸ਼ਨ ਹੋਏਗੀ ਨਹੀਂ ਸਰ ਆ ਅੱਗੇ ਨਹੀਂ ਹੋ ਸਕਦੀਆਂ ਮਤਲਬ ਆਪਾਂ ਦਸ ਦਿਨ ਬਾਅਦ ਜਿਵੇਂ ਅੱਗੇ ਅੱਗੇ ਵੀ ਜਾਣਾ ਹੁਣ ਨਹੀਂ ਜਾ ਸਕਦਾ ਨਹੀਂ ਸਰ ਪਹਿਲਾਂ ਤਾਂ ਵੀਹ ਪ੍ਰਸੈਂਟ ਡਿਟੈਕਟ ਹੁੰਦੇ ਸੀ ਸਰ ਪੱਚੀ ਨਵੰਬਰ ਨੂੰ ਫੈਮਿਲੀ 'ਚ ਕੋਈ ਇਸ਼ੂ ਹੋ ਗਿਆ ਸਾਨੂੰ ਹੋਰ ਕਿੱਥੇ ਜਾਣਾ ਪੈ ਰਿਹਾ ਅਤੇ ਇਸ ਲਈ ਅਸੀਂ ਇਸ ਲਈ ਅਸੀਂ ਅਗਲੀ ਟ੍ਰੇਨ ਜਦੋਂ ਵੀ ਹੋਏਗੀ ਉਦੋਂ ਜਾਣ ਲਈ ਕਹਿ ਰਹੇ ਸੀ ਤਾਂ ਹੀ ਮੈਂ ਫੋਨ ਕੀਤਾ ਸੀ ਵੀ ਕੀ ਪਤਾ ਅੱਗੇ ਹੋ ਜਾਵੇ ਟਿਕਟ ਵੀ ਡਿਡਕਟ ਨਾ ਹੋਣ ਪੈਸੇ

ਅੱਛਾ ਜੀ ਨਹੀਂ ਸਰ ਫੇਰ ਵੀ ਵੇਖ ਲਓ ਜੇ ਹੁੰਦਾ ਤਾਂ

ਨਹੀਂ ਸਰ ਮੈਂ ਨਹੀਂ ਹੁਣ ਆ ਮਤਲਬ ਇਹਦਾ ਰੂਲ ਹੀ ਹੈਗੇ ਕਿਉਂਕਿ ਆਹ ਨਾ ਦਸ ਦਿਨ ਪਹਿਲਾਂ ਬੁੱਕ ਹੁੰਦੀ ਹੈ ਟਰੇਨ ਨਹੀਂ ਆਪਾਂ ਐਵੇਂ ਨਹੀਂ ਐ ਵੀ ਮੌਕੇ 'ਤੇ ਬੁੱਕ ਕਰ ਸਕੀਏ ਕੁਝ ਵੀ ਟਾਈਮ ਨਾਲ ਸਰ ਹੁਣ ਕਰਾਈ ਤਾਂ ਟਾਈਮ ਨਾਲ ਸੀ ਪਰ ਚਲੋ ਉਹ ਨਹੀਂ ਕੁਝ ਫੈਮਲੀ ਪ੍ਰੋਬਲਮ ਕਰਕੇ ਜਾ ਸਕੇ ਚਲੋ ਕੋਈ ਨਹੀਂ ਸਰ ਹਾਂਜੀ ਠੀਕ ਠੀਕ ਹੈ ਸਰ ਠੀਕ ਓਕੇ